ਮੈਂ ਬਸ ਯਾਤਰਾ ਕਈ ਵਾਰੀ ਕੀਤੀ ਹੈ ਅਤੇ ਮੈਨੂੰ ਬਸ ਯਾਤਰਾ ਕਰਨਾ ਬੜਾ ਚੰਗਾ ਲੱਗਦਾ ਹੈ ਚੰਗਾ ਇਸ ਕਰਕੇ ਲੱਗਦਾ ਹੈ ਇੱਥੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਦੇਖਣ ਨੂੰ ਮਿਲਦੇ ਹਨ ਕੋਈ ਪੰਜਾਬ ਦਾ ਬੰਦਾ ਹੁੰਦਾ ਹੈ ਕੋਈ ਰਾਜਸਥਾਨ ਤੋਂ ਆਇਆ ਹੁੰਦਾ ਕੋਈ ਹਿਮਾਚਲ ਦਾ ਹੈ ਕੋਈ ਹਰਿਆਣਾ ਦਾ ਹੈ ਇਹਨਾਂ ਦੀ ਆਪਣੀ ਆਪਣੀ ਭਾਸ਼ਾਵਾਂ ਕਈ ਗੱਲਾਂ ਦੇ ਬਹੁਤ ਗਲਾਦੜ ਹੁੰਦੇ ਹਨ ਬਹੁਤ ਚੰਗੀਆਂ ਗੱਲਾਂ ਸਾਨੂੰ ਦੱਸਦੇ ਹਨ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਵੀ ਆਉਂਦਾ ਹੈ ਇੱਥੋਂ ਸਾਨੂੰ ਪਤਾ ਚੱਲਦਾ ਹੈ ਡਰਾਈਵਰ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਹੈ ਕੰਡਕਟਰ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਹੈ ਕਿੱਦਾਂ ਉਹ ਲੋਕਾਂ ਨੂੰ ਆਵਾਜ਼ਾਂ ਦਿੰਦਾ ਹੈ ਆਓ ਜੀ ਆਓ ਸਾਡੇ ਬੱਸ ਦੇ ਵਿੱਚ ਬੈਠੋ ਉਹ ਕਿਸ ਤਰ੍ਹਾਂ ਆਪਣੇ ਰੋਜ਼ਗਾਰ ਨੂੰ ਵਧਾਉਣ ਲਈ ਕਿੱਦਾਂ ਆਕਰਸ਼ਿਤ ਕਰਦਾ ਹੈ ਲੋਕਾਂ ਨੂੰ ਇਹ ਸਭ ਕੁਛ ਦੇਖਣਾ ਮੈਨੂੰ ਬੜਾ ਚੰਗਾ ਲੱਗਦਾ ਹੈ ਫਿਰ ਬਸ ਕਈ ਜਗ੍ਹਾ 'ਤੇ ਰੁਕਦੀ ਹੈ ਉੱਥੇ ਕੋਈ ਕੁਛ ਵੇਚਣ ਲਈ ਆ ਜਾਂਦਾ ਹੈ ਕਦੀ ਕੁਛ ਵੇਚਣ ਲਈ ਆ ਜਾਂਦਾ ਹੈ ਸਾਨੂੰ ਇਹੀ ਚੀਜ਼ਾਂ ਬਹੁਤ ਜਾਗਰੂਕ ਕਰਵਾਉਂਦੀਆਂ ਹਨ ਕਿ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਲਈ ਲੋਕੀ ਕੀ ਕੀ ਕਰਦੇ ਹਨ ਮੈਨੂੰ ਬਸ ਯਾਤਰਾ ਕਰਨਾ ਇਸ ਕਰਕੇ ਵੀ ਬਹੁਤ ਵਧੀਆ ਲੱਗਦਾ ਹੈ ਸਾਨੂੰ ਸਮਾਜ ਦੇ ਵਿੱਚ ਲੋਕੀ ਕਿੱਦਾਂ ਸੋਚਦੇ ਹਨ ਕੁਛ ਪਤਾ ਚਲਦਾ ਹੈ ਇਸ ਕਰਕੇ ਬਸ ਯਾਤਰਾ ਮੈਂ ਵੀ ਕੀਤੀ ਹੈ ਅਤੇ ਮੈਨੂੰ ਵੀ ਚੰਗੀ ਲੱਗਦੀ ਹੈ